ਹਾਂ ਮੈਨੂੰ ਦੋੜਨਾ ਪਸੰਦ ਹੈ ਮੈਂ ਰੋਜ਼ ਸਵੇਰੇ ਜੋਗਿੰਗ ਕਰਦਾ ਹਾਂ ਜਿਹਦੇ ਨਾਲ ਮੇਰਾ ਸਰੀਰ ਬਹੁਤ ਵਧੀਆ ਤੰਦਰੁਸਤ ਰਹਿੰਦਾ ਹੈ ਨਾ ਮੇਰਾ ਜ਼ਿਆਦਾ ਭਾਰ ਵੱਧਦਾ ਹੈ ਮੇਰਾ ਮਾਨਸਿਕ ਤਨਾਓ ਵੀ ਘੱਟ ਰਹਿੰਦਾ ਹੈ ਅਤੇ ਮੇਰੀ ਫੋਕਸ ਕਰਨ ਦੀ ਕਾਬਲੀਅਤ ਵੀ ਵੱਧਦੀ ਹੈ ਮੈਂ ਕਿਸੇ ਕੰਮ ਨੂੰ ਚੰਗੇ ਤਰੀਕੇ ਨਾਲ ਕਰ ਪਾਉਂਦਾ ਹਾਂ ਮੈਂ ਪਟਿਆਲੇ ਜ਼ਿਲ੍ਹੇ 'ਚ ਹੋਣ ਵਾਲੀ ਮੈਰਾਥੋਨ ਵਿੱਚ ਵੀ ਕਈ ਵਾਰ ਹਿੱਸਾ ਲਿਤਾ ਹੈ ਜਿੱਥੇ ਕਈ ਵਾਰ ਦਸ ਦਸ ਪੰਦਰਾਂ ਪੰਦਰਾਂ ਕਿਲੋਮੀਟਰ ਦੀ ਰਨਿੰਗ ਹੁੰਦੀ ਹੈ ਰਨਿੰਗ ਦੇ ਹੋਰ ਵੀ ਬਹੁਤ ਸਾਰੇ ਫਾਇਦੇ ਹਨ ਜਿਵੇਂ ਕਿ ਆਪਣਾ ਸਰੀਰ ਹੱਡਾਂ ਦੇ ਜੋੜਾਂ ਦੇ ਦਰਦ ਨਹੀਂ ਹੁੰਦਾ ਐਨ ਵਧੀਆ ਰਹਿੰਦੇ ਹਨ ਉਹਨਾਂ ਦੀ ਫਲੈਕਸੀਬਿਲਟੀ ਬਣੀ ਰਹਿੰਦੀ ਹੈ ਕਿਹਾ ਜਾਂਦਾ ਹੈ ਕੀ ਰਨਿੰਗ ਕਰਨ ਨਾਲ ਉਮਰ ਵੀ ਵੱਧਦੀ ਹੈ ਤਾਂ ਮੇਰੇ ਅਕੋਰਡਿੰਗ ਸਭ ਨੂੰ ਰਨਿੰਗ ਕਰਨੀ ਚਾਹੀਦੀ ਹੈ ਹੋ ਸਕੇ ਤਾਂ ਸਵੇਰੇ ਉੱਠ ਕੇ ਰਨਿੰਗ ਨਹੀਂ ਕਰ ਸਕਦੇ ਤਾਂ ਵੋਕਿੰਗ ਕਰ ਲਓ ਜੋਗਿੰਗ ਕਰ ਲਓ ਪਰ ਇਹ ਹਰੇਕ ਬੰਦੇ ਨੂੰ ਕਰਨਾ ਚਾਹੀਦਾ ਹੈ